ਹਾਂ ਮੈਂ ਆਪਣੀ ਭੈਣ ਨੂੰ ਪੜ੍ਹਾਉਣਾ ਪੜ੍ਹਾਉਣਾ ਚਾਹੁੰਦੀ ਹਾਂ ਕਿਉਂਕਿ ਪੜ੍ਹਾਈ ਆਮ ਆਉਣ ਵਾਲੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ ਪੜ੍ਹਾਈ ਕਰਨ ਨਾਲ ਜਿੰਨੀ ਜ਼ਿਆਦਾ ਸਿੱਖਿਆ ਹੋਏਗੀ ਤਾਂ ਵਧੀਆ ਤੋਂ ਵਧੀਆ ਨੌਕਰੀ ਲੱਗ ਸਕੇਗੀ ਅਤੇ ਜਿਸ ਨਾਲ ਉਸਨੂੰ ਜਿਹੜੀਆਂ ਕਿ ਉਸਦੀ ਆਪਦੀ ਜ਼ਰੂਰਤਮੰਦਾਂ ਦੀਆਂ ਚੀਜਾਂ ਜਾਂ ਲੋੜਾਂ ਹਨ ਉਹ ਆਪਣੀ ਖੁਸ਼ੀ ਖੁਸ਼ੀ ਪੂਰੀਆਂ ਕਰ ਸਕੇ ਅਤੇ ਕੱਲ੍ਹ ਉਹ ਆਪਣੇ ਫਿਊਚਰ ਬਾਰੇ ਵੀ ਆਪ ਦੇਖ ਸਕਦੀ ਹੈ ਜੇਕਰ ਅਸੀਂ ਜੇਕਰ ਉਹ ਪੜੀ ਲਿਖੀ ਹੋਏਗੀ ਤਾਂ ਕੱਲ੍ਹ ਆਪਣੇ ਪੈਰਾਂ 'ਤੇ ਆਪ ਖੜ੍ਹੀ ਹੋ ਸਕਦੀ ਹੈ ਅਤੇ ਉਸ ਨਾਲ ਉਸਦੀਆਂ ਜੋ ਵੀ ਚੀਜ਼ਾਂ ਲੋੜਾਂ ਹੋਣਗੀਆਂ ਉਹ ਆਪਣੀ ਖੁਦ ਆਪ ਪੂਰੀਆਂ ਕਰ ਸਕਦੀ ਹੈ ਜੇਕਰ ਉਹ ਪੜ੍ਹੀ ਲਿਖੀ ਵੱਧ ਹੋਏਗੀ ਤਾਂ ਉਹਨੂੰ ਨੌਕਰੀ ਵਧੀਆ ਮਿਲੇਗੀ ਉਸ ਦੀ ਲਾਈਫ ਵਧੀਆ ਰਹੇਗੀ ਅਤੇ ਉਹਨੂੰ ਹੋਰ ਵੀ ਅੱਗੇ ਜਾ ਕੇ ਸਿੱਖਣ ਲਈ ਬਹੁਤ ਕੁਝ ਮਿਲੇਗਾ ਹਾਂ ਲੜਕਿਆਂ ਨੂੰ ਪੜ੍ਹਨ ਵੇਲੇ ਵੀ ਮਿਲ ਜਦੋਂ ਮੈਂ ਪੜ੍ਹਦੀ ਸੀ ਤਾਂ ਮੈਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਵੇਂ ਪਿੰਡਾਂ ਦੇ ਵਿੱਚ ਹੁੰਦਾ ਹੈ ਕਿ ਕੋਲੇਜ ਦੂਰ ਨੇੜੇ ਜਾਂ ਬਹੁਤ ਇਸ਼ੂ ਹੁੰਦਾ ਫੀਸਾਂ ਦਾ ਜੋ ਕਿ ਮੇਰੇ ਪੇਰੈਂਟਸ ਨੂੰ ਬਹੁਤ ਔਖਾ ਲੱਗਦਾ ਸੀ ਪਰ ਫਿਰ ਵੀ ਬਹੁਤ ਮੁਸ਼ਕਿਲ ਨਾਲ ਉਹਨੇ ਮੈਨੂੰ ਪੜ੍ਹਾਇਆ ਇਹੀ ਮੁਸ਼ਕਿਲਾਂ ਕਰਕੇ ਹੀ ਮੇਰੇ ਆਉਂਦੀਆਂ ਹਨ ਜਦੋਂ ਕਿ ਦੂਰ ਨੇੜੇ ਕਰਕੇ ਜਦੋਂ ਸਿੱਖਿਆ ਬੱਚਾ ਪ੍ਰਾਪਤ ਕਰਦਾ ਤਾਂ ਉਸਨੂੰ ਥੋੜ੍ਹੀ ਬਹੁਤੀਆਂ ਮੁਸ਼ਕਿਲਾਂ ਦਾ ਕਰਨਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਮੈਨੂੰ ਵੀ ਸਾਹਮਣਾ ਕਰਨਾ ਪਿਆ ਸੀ ਪਰ ਮੇਰੇ ਪੇਰੈਂਟਸ ਫਿਰ ਵੀ ਮੇਰੇ ਮਾਤਾ ਪਿਤਾ ਨੇ ਮੈਨੂੰ ਵਧੀਆ ਪੜ੍ਹਾਇਆ ਲਿਖਾਇਆ ਅਤੇ ਮੈਂ ਵੀ ਚਾਹੁੰਦੀ ਹਾਂ ਕਿ ਮੈਂ ਆਪਣੀ ਭੈਣ ਨੂੰ ਵਧੀਆ ਪੜ੍ਹਾ ਲਿਖਾ ਸਕਾਂ ਤਾਂ ਜੋ ਉਸਦਾ ਫਿਊਚਰ ਵਧੀਆ ਬਣ ਸਕੇ